ਮੈਨੂੰ ਲੱਗਦਾ ਕਿ ਪੇਂਡੂ ਖੇਤਰ ਵਿੱਚ ਸਰਕਾਰੀ ਰਾਸ਼ਨ ਦੇ ਵਿੱਚ ਕਾਫੀ ਸਾਰੀਆਂ ਗੱਲਾਂ ਕਰਕੇ ਉੱਥੇ ਕੰਮ ਨਹੀਂ ਹੋ ਪਾ ਰਿਹਾ ਪਹਿਲੀ ਤਾਂ ਹੈਗੀ ਜਨਤਕ ਸੇਵਾ ਜਿਹੜੇ ਉੱਥੇ ਕੰਮ ਕਰਨ ਵਾਲੇ ਵਰਕਰ ਹੈਗੇ ਆ ਪੇਂਡੂ ਸਰਕਾਰੀ ਰਾਸ਼ਨ ਡਿਪੂਆਂ ਵਿੱਚ ਉਹ ਲੋਕਾਂ ਨੂੰ ਵਰਤਾਓ ਸਹੀ ਨਹੀਂ ਕਰਦੇ ਅਤੇ ਉਹਨਾਂ ਦਾ ਵਰਤਾਓ ਬਹੁਤ ਜ਼ਿਆਦਾ ਰੁੱਖਾ ਹੁੰਦਾ ਅਤੇ ਜਿਸ ਕਰਕੇ ਲੋਕ ਉਹਨਾਂ ਕੋਲ ਜਾਣਾ ਪਸੰਦ ਨਹੀਂ ਕਰਦੇ ਪਰ ਕੀ ਕਰਨ ਮਜਬੂਰੀ ਹੈ ਰਾਸ਼ਨ ਲੈਣ ਲਈ ਜਾਣਾ ਪੈਂਦਾ ਅਤੇ ਉਸ ਤੋਂ ਬਾਅਦ ਆਉਂਦੀਆਂ ਸਰਕਾਰ ਨੂੰ ਜਿਹੜੀਆਂ ਨੀਤੀਆਂ ਬਣਾਈਆਂ ਗਈਆਂ ਹੈ ਜਾਂ ਜਿਹੜੀ ਅੱਜ ਕੱਲ੍ਹ ਰਾਜਨੀਤਿਕ ਗੱਲਾਂ ਚੱਲ ਰਹੀਆਂ ਪਿਛਲੀਆਂ ਸਰਕਾਰਾਂ ਨੇ ਕੁਛ ਰੂਲ ਬਣਾਏ ਸੀਗੇ ਉਹ ਉਹਨਾਂ ਨੇ ਆਪਣੇ ਅਕੋਰਡਿੰਗ ਬਣਾਏ ਸੀ ਨਵੀਂ ਸਰਕਾਰਾਂ ਨੇ ਆ ਕੇ ਬਣਾ ਤਾ ਵੀ ਅਸੀਂ ਤੁਹਾਨੂੰ ਇਹ ਸਕੀਮ ਦੇ ਅਕੋਰਡਿੰਗ ਆਪਾਂ ਇੱਦਾਂ ਤੁਹਾਨੂੰ ਦੇਵਾਂਗੇ ਅਤੇ ਉਹਦੇ ਕਰਕੇ ਕੀ ਹੁੰਦਾ ਕੀ ਲੋਕਾਂ ਨੂੰ ਨਵੀਂ ਸਕੀਮ ਅਤੇ ਪੁਰਾਣੀ ਸਕੀਮ ਸਮਝਣ 'ਚ ਬਹੁਤ ਜ਼ਿਆਦਾ ਕਠਿਨਾਈ ਆਉਂਦੀ ਹੈ